ਹਾਂਜੀ ਸਰ ਤੁਸੀਂ ਅਰਬਨ ਏਸਟੇਟ ਫੇਸ ਟੂ ਤੋਂ ਬੋਲ ਰਹੇ ਹੋ ਡੋਮੀਨਸ ਤੋਂ ਸਰ ਮੈਂ ਤੁਹਾਨੂੰ ਮਾਰਗਰੀਟਾ ਪੀਜ਼ਾ ਔਡਰ ਕੀਤਾ ਸੀਗਾ ਐਕਸਟਰਾ ਚੀਜ਼ ਨਾਲ ਪਰ ਤੁਸੀਂ ਮੈਨੂੰ ਵੈਜੀਟੇਬਲ ਵਾਲਾ ਭੇਜਤਾ ਮੈਨੂੰ ਇਹ ਪੀਜ਼ਾ ਨਹੀਂ ਚਾਹੀਦਾ ਜਾਂ ਤਾਂ ਤੁਸੀਂ ਇਹਨੂੰ ਰਿਪਲੇਸ ਕਰ ਦਿਉ ਆਪਣਾ ਇਹ ਪੀਜ਼ਾ ਵਾਪਿਸ ਲੈ ਜਾਓ ਅਤੇ ਮੇਰੇ ਪੈਸੇ ਰਿਫੰਡ ਕਰ ਦਿਉ ਦੇਖੋ ਮੈਂ ਹਮੇਸ਼ਾ ਹੀ ਤੁਹਾਡੇ ਤੋਂ ਲੈਂਦੀ ਹਾਂ ਅੱਗੇ ਕਦੇ ਕੰਪਲੇਂਟ ਨਹੀਂ ਹੋਈ ਇਸ ਲਈ ਇਹਨੂੰ ਕਲੈਕਟ ਕਰੋ ਅਤੇ ਮੇਰੇ ਪੈਸੇ ਰਿਫੰਡ ਕਰ ਦਿਉ